ਹਾਂ ਮੈਂ ਪੰਛੀਆਂ ਦਾ ਸ਼ਿਕਾਰ ਹੁੰਦੇ ਦੇਖਿਆ ਹੈ ਕਈ ਵਾਰ ਕੋਈ ਕਿਸੇ ਕਬੂਤਰਾਂ ਨੂੰ ਮਾਰਦਾ ਹੈ ਜਾਂ ਕੁਛ ਕਿੱਦਾਂ ਵੀ ਆ ਅਸੀਂ ਉਸਨੂੰ ਦੇਖਿਆ ਹੈ ਅਤੇ ਪੰਛੀ ਜਾਲ ਵਿੱਚ ਵੀ ਫਸੇ ਹੋਏ ਦੇਖੇ ਹਨ ਅਸੀਂ ਜਦੋਂ ਛੋਟੇ ਸੀ ਅਸੀਂ ਇਹ ਚੀਜ਼ਾਂ ਦੇਖਦੇ ਹੁੰਦੇ ਸੀ ਪਰ ਸਾਨੂੰ ਬੜਾ ਦੁੱਖ ਹੁੰਦਾ ਸੀ ਕਿ ਅਸੀਂ ਕੀ ਕਰੀਏ ਅਤੇ ਦੇਖਿਆ ਹੈ ਉਨ੍ਹਾਂ ਦਾ ਸ਼ਿਕਾਰ ਹੁੰਦੇ ਵੀ ਅਤੇ ਅਫ਼ਸੋਸ ਹੁੰਦਾ ਸੀ ਉਨ੍ਹਾਂ ਨੂੰ ਜਦੋਂ ਕੋਈ ਮਾਰਦਾ ਸੀ